ਮੇਰੇ ਸ਼ਹਿਰ ਸ਼ਹੀਦ ਭਗਤ ਸਿੰਘ ਨਿ ਨ ਨਗਰ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਔਰ ਬਹੁਤ ਸਾਰੀਆਂ ਗਤੀਵਿਧੀਆਂ ਇੱਦਾਂ ਦੀਆਂ ਹੁੰਦੀਆਂ ਹਨ ਬਟ ਮੇਰ ਮੈਂ ਕ੍ਰਿਕਟ ਨੂੰ ਪਹਿਲ ਕਰਦੀ ਹਾਂ ਕਿਉਂਕਿ ਸਾਡੇ ਇੱਥੇ ਕ੍ਰਿਕਟ ਦੀ ਇੱਕ ਸਟੇਡੀਅਮ ਹੈ ਜਿੱਥੇ ਸ਼ਾਮ ਨੂੰ ਔਰ ਕਈ ਟਾਈਮ ਟੂਰਨਾਮੈਂਟ ਸ਼ਾਮ ਨੂੰ ਬੱਚੇ ਖੇਡਣ ਜਾਂਦੇ ਹਨ ਔਰ ਇੱਥੇ ਟੂਰਨਾਮੈਂਟ ਵੀ ਕਰਾਇਆ ਜਾਂਦਾ ਹੈ ਉਸ ਟੂਰਨਾਮੈਂਟ ਨੂੰ ਦੇਖਣ ਲਈ ਲੋਕ ਪਿੰਡਾਂ ਦੇ ਲੋਕ ਇਕੱਠੇ ਕਈ ਵਾਰ ਹੁੰਦੇ ਹਨ ਔਰ ਕਈ ਦੋ ਟੀਮਾਂ ਦੇ ਵਿਚਕਾਰ ਜਦੋਂ ਮੈਚ ਹੁੰਦਾ ਹੈ ਤਾਂ ਬਹੁਤ ਹੀ ਜ਼ਿਆਦਾ ਉਤਸ਼ਾਹ ਦੇਖਿਆ ਜਾਂਦਾ ਹੈ ਮੈਂ ਖ਼ੁਦ ਵੀ ਆਪਣੇ ਬੱਚਿਆਂ ਨੂੰ ਉੱਥੇ ਕੇ ਖੇਡਣ ਨੂੰ ਭੇਜਦੀ ਹਾਂ ਸੰਡੇ ਨੂੰ ਸੰਡੇ ਉਹਨਾਂ ਨੂੰ ਖੇਡਣ ਨੂੰ ਭੇਜਦੀ ਹਾਂ ਤਾਂ ਕਿ ਜਿਸ ਨਾਲ ਉਹਨਾਂ ਦਾ ਸਰੀਰ ਚੁਸਤ ਦਰੁਸਤ ਔਰ ਫਿੱਟ ਰਵੇ ਔਰ ਇਹਦੇ ਨਾਲ ਉਹਨਾਂ ਦਾ ਇੱਕ ਉਹਨਾਂ ਨੂੰ ਆਪਣੇ ਖੇਡ ਦੇ ਬਾਰੇ ਵੀ ਜਾਣਕਾਰੀ ਪੂਰੀ ਹੁੰਦੀ ਆ ਔਰ ਇਸ ਤੋਂ ਇਲਾਵਾ ਇੱਥੇ ਸਾਡੇ ਕੋਲ ਰੰਗਾ ਰੰਗ ਪ੍ਰੋਗਰਾਮ ਵੀ ਹੁੰਦਾ ਹੈ ਜਿਹਦੇ ਵਿੱਚ ਹਰ ਇੱਕ ਭਾਈਚਾਰੇ ਔਰ ਪਰੰਪਰਾ ਦੇ ਅਕੋਡਿੰਗ ਉੱਥੇ ਦਿਖਾਇਆ ਜਾਂਦਾ ਹੈ ਜਿਵੇਂ ਕਿ ਗੱਲ ਕਰੀਏ ਗਿੱਧਾ ਗਿੱਧੇ ਦੇ ਅਕੋਡਿੰਗ ਉਹ ਆਪਣਾ ਹਰ ਸ਼ੌਕ ਵਾਪਰ ਕਰਦੇ ਹਨ ਪੁਰਾਣੀਆਂ ਬੋਲੀਆਂ ਗਨੀ ਗਾਈਆਂ ਜਾਂਦੀਆਂ ਕਿਸ ਤਰ੍ਹਾਂ ਕ ਚਰਖਾ ਕੱਤਿਆ ਜਾਂਦਾ ਸੀ ਕਿੱਦਾਂ ਪੱਖੀਆਂ ਕਰਦੇ ਸੀ ਕਿੱਦਾਂ ਬਾਤਾਂ ਹੁੰਦੀਆਂ ਸੀ ਸਾਰੀਆਂ ਚੀਜ਼ਾਂ ਇਹ ਬੱਚਿਆਂ ਨੂੰ ਦਿਖਾਈ ਜਾਂਦੀਆਂ ਹਨ ਔਰ ਮੈਂ ਆਪਣੇ ਬੱਚਿਆਂ ਨੂੰ ਇਹਨਾਂ ਸਾਰੇ ਹੀ ਐਕਟੀਵਿਟੀਜ਼ ਨੂੰ ਦਿਖਾਉਂਦੀ ਆ ਔਰ ਜਿਸ ਦੇ ਨਾਲ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਵੀ ਪਤਾ ਲੱਗਦਾ ਹੈ ਔਰ ਉਹਨਾਂ ਦਾ ਇੱਕ ਮਨੋਰੰਜਨ ਦਾ ਨਮ ਸਾਧਨ ਵੀ ਬਣਦਾ ਹੈ